ਜੇ ਯੂ ਪੀ ਆਈ ਦੀ ਗੱਲ ਕੀਤੀ ਜਾਵੇ ਹੈ ਨਾ ਗੂਗਲ ਤੋਂ ਵੀ ਆਪਾਂ ਪੇਮੈਂਟ ਕਰ ਸਕਦੇ ਹਾਂ ਅਤੇ ਪੇ ਟੀ ਐੱਮ ਤੋਂ ਵੀ ਪੇਮੈਂਟ ਕਰ ਸਕਦੇ ਹਾਂ ਇਹਦੇ ਵਿੱਚ ਜਿਹੜਾ ਯੂ ਪੀ ਆਈ ਦਾ ਫ਼ੰਕਸ਼ਨ ਹੈ ਜਾਂ ਯੂ ਪੀ ਆਈ ਦੀ ਜੋ ਸਹੂਲਤ ਹੈ ਸਹੂਲੀਅਤ ਹੈ ਹੈ ਨਾ ਬਹੁਤ ਵਧੀਆ ਹੈਗੀ ਇਹ ਅਤੇ ਹੁਣ ਜ਼ਿਆਦਾਤਰ ਜੋ ਲੋਕ ਨੇ ਯੂ ਪੀ ਆਈ ਦੁਆਰਾ ਹੀ ਪੇਮੈਂਟ ਕਰਦੇ ਆ ਅਤੇ ਜੇ ਮੈਂ ਆਪਣੀ ਗੱਲ ਕਰਾਂ ਮੈਂ ਵੀ ਕੈਸ਼ ਬਹੁਤ ਘੱਟ ਯੂਜ ਕਰਦਾ ਗਾ ਅਤੇ ਕੈਸ਼ ਦੀ ਹੁਣ ਜੋ ਮਤਲਬ ਯੂਜਿਸ ਦਾ ਬਹੁਤ ਜ਼ਿਆਦਾ ਘੱਟ ਗਏ ਜਦੋਂ ਦਾ ਆਹ ਗੂਗਲ ਪੇ ਵੱਟਸਐਪ 'ਤੇ ਜਿਹੜੇ ਯੂ ਪੀ ਆਈ ਦੀ ਜੋ ਸਹੂਲਤ ਮਿਲੀ ਆ ਅਤੇ ਉਹਦੇ ਕਰਕੇ ਜ਼ਿਆਦਾਤਰ ਲੋਕ ਹੁਣ ਜਿੱਥੇ ਕਿਤੇ ਵੀ ਕੋਈ ਵੀ ਖਰੀਦਦਾਰੀ ਕਰਨੀ ਹੈਗੀ ਯੂ ਪੀ ਆਈ ਕਰਦੇ ਹੈ ਪੇਮੈਂਟ ਓਥੇ ਸਕੈਨਰ ਲੱਗੇ ਨੇ ਅਤੇ ਸਕੈਨ ਕਰੋ ਨਾਲ ਦੀ ਨਾਲ ਪੇਮੈਂਟ ਕਰੋ ਅਤੇ ਯੂ ਪੀ ਆਈ ਦਾ ਇੱਕ ਵੱਡਾ ਫ਼ਾਈਦਾ ਇਹ ਵੀ ਹੈ ਵੀ ਉਹਦੇ ਨਾਲ ਜੋ ਆਪਾਂ ਨੋਰਮਲੀ ਦੇਖਦੇ ਸੀ ਵੀ ਖੁੱਲੇ ਪੈਸੇ ਹੈ ਨਾ ਉਨ੍ਹਾਂ ਦੀ ਦਿੱਕਤ ਆਉਂਦੀ ਸੀ ਉਹ ਪ੍ਰੋਬਲਮ ਬਿਲਕੁਲ ਖ਼ਤਮ ਹੋ ਗਈ ਅਤੇ ਜੋ ਕੈਸ਼ ਆ ਕੈਸ਼ ਦੀ ਜੋ ਫਲੋ ਕੈਸ਼ ਦਾ ਫਲੋ ਬਹੁਤ ਜ਼ਿਆਦਾ ਘੱਟ ਗਿਆ ਲੋਕ ਜ਼ਿਆਦਾ ਤੋਂ ਜ਼ਿਆਦਾ ਯੂ ਪੀ ਆਈ ਨੂੰ ਹੀ ਤਵੱਜੋਂ ਦਿੰਦੇ ਹੈਗੇ ਅਤੇ ਇਹਦੇ ਬਹੁਤ ਜ਼ਿਆਦਾ ਫ਼ਾਇਦੇ ਵੀ ਆ ਤੁਹਾਨੂੰ ਕਿਤੇ ਵੀ ਜੇ ਤੁਸੀਂ ਜਾ ਰਹੇ ਓਂ ਗੇ ਕਿਸੇ ਵੀ ਸ਼ਹਿਰ ਦੇ ਵਿੱਚ ਅਤੇ ਈਵਨ ਕੇ ਹੁਣ ਤਾਂ ਜ਼ਿਆਦਾਤਰ ਜੋ ਛੋਟੇ ਤੋਂ ਛੋਟੇ ਵਪਾਰੀ ਨੇ ਰੇਹੜੀਆਂ ਵਾਲੇ ਨੇ ਉਨ੍ਹਾਂ ਕੋਲ ਵੀ ਸਕੈਨਰ ਲੱਗੇ ਹੋਏ ਹੈਗੇ ਉੱਥੇ ਜਾ ਕੇ ਉੱਥੇ ਜੇ ਤੁਹਾਡੇ ਕੋਲ ਕੈਸ਼ ਹੈ ਨਹੀਂ ਗਾ ਇਕੱਲਾ ਫੋਨ ਹੈ ਤੁਹਾਡੇ ਕੋਲ ਫੋਨ ਦੇ ਦੁਆਰਾ ਵੀ ਤੁਸੀਂ ਆਪਣੀ ਸ਼ੋਪਿੰਗ ਕਰ ਸਕਦੇ ਹੋ ਛੋਟੀ ਤੋਂ ਛੋਟੀ ਚੀਜ਼ ਵੱਡੀ ਤੋਂ ਵੱਡੀ ਚੀਜ਼ ਜਿਹੜੀ ਹੈਗੀ ਐਗੀ ਖਰੀਦ ਸਕਦੇ ਜੋ ਸਾਡੀਆਂ ਸਾਡੀਆਂ ਰੋਜ਼ਾਨਾ ਜੀਵਨ ਦੀਆਂ ਤੁਹਾਡੀਆਂ ਜੋ ਲੋੜ੍ਹਾਂ ਹੁੰਦੀਆਂ ਅਤੇ ਉਹ ਅਸੀਂ ਮਤਲਬ ਯੂ ਪੀ ਆਈ ਦੁਆਰਾ ਚੀਜ਼ਾਂ ਨੂੰ ਖਰੀਦ ਸਕਦੇ ਹੈਗੇ ਹੈ ਨਾ ਅਤੇ ਇਨ੍ਹਾਂ ਚੀ ਇਹ ਚੀਜ਼ਾਂ ਨੇ ਮਤਲਬ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਆਸਾਨ ਬਣਾ ਦਿੱਤਾ ਅਤੇ ਹੁਣ ਲੋਕ ਇਸ ਚੀਜ਼ ਦੀ ਬਹੁਤ ਜ਼ਿਆਦਾ ਯੂਜ ਕਰ ਰਹੇ ਨੇ ਅਤੇ ਪਰ ਦੇਖਿਆ ਜਾਵੇ ਕਿਤੇ ਨਾ ਕਿਤੇ ਜੇ ਚੀਜ਼ ਦਾ ਕਿਤੇ ਕੁਛ ਨਾ ਕੁਛ ਪੋਜਟਿਵ ਹੁੰਦੇ ਅਤੇ ਨੈਗੇਟਿਵ ਵੀ ਇਹਦੇ ਇਫੈਕਟ ਪੈ ਰਹੇ ਨੇ ਕੁਛ ਲੋਕ ਹੁੰਦੇ ਨੇ ਜਿਹ ਜਿਹੜੇ ਘੱਟ ਪੜ੍ਹੇ ਲਿਖੇ ਨੇ ਜਾਂ ਜੋ ਘੱਟ ਅਵੇਅਰ ਨੇ ਉਨ੍ਹਾਂ ਨਾਲ ਫਰੋਡ ਵੀ ਬਹੁਤ ਜ਼ਿਆਦਾ ਹੁੰਦੇ ਨੇ ਅਤੇ ਇਸ ਚੀਜ਼ ਦਾ ਮਤਲਬ ਹੋਣਾ ਚਾਹੀਦਾ ਕੋਈ ਨਾ ਕੋਈ ਉਨ੍ਹਾਂ ਨੂੰ ਪ੍ਰੋਪਰ ਤਰੀਕੇ ਨਾਲ ਉਨ੍ਹਾਂ ਨੂੰ ਟ੍ਰੇਨਿੰਗ ਦੇਣੀ ਚਾਹੀਦੀ ਹੈ ਜਾਂ ਸਮਝਾਇਆ ਜਾਣਾ ਚਾਹੀਦਾ ਅਤੇ ਜਿੱਦਾਂ ਤੁਸੀਂ ਦੇਖਦੇ ਹੋ ਕੇ ਕੁਛ ਆਸੇ ਪਾਸੇ ਓ ਟੀ ਪੀ ਲੈ ਕੇ ਕਿਸੇ ਦੇ ਫੋਨ ਦੇ ਵਿੱਚੋਂ ਪੇਮੈਂਟ ਜਿਹੜੀ ਹੈਗੀ ਹੈ ਕੱਢ ਲਈ ਜਾਂਦੀ ਹੈਗੀ ਅਤੇ ਉਹ ਕਿਤੇ ਨਾ ਕਿਤੇ ਜੋ ਟੈਕਨੋਲਜੀ ਹੈ ਉਹ ਤਾਂ ਗਲਤ ਯੂਜ ਹੋ ਰਿਆ ਜੋ ਪ੍ਰੋਪਰ ਅਵੇਅਰ ਨਹੀਂ ਹੈ ਜਾਂ ਜਿਸਨੂੰ ਘੱਟ ਪੜ੍ਹੇ ਲਿਖੇ ਨੇ ਜਾਂ ਇਨ੍ਹਾਂ ਚੀਜ਼ਾਂ ਦੀ ਯੂਜ ਕਰਨਾ ਇਸਤੇਮਾਲ ਕਰਨਾ ਨਹੀਂ ਆਉਂਦਾ ਉਨ੍ਹਾਂ ਨਾਲ ਬਹੁਤ ਜ਼ਿਆਦਾ ਫਰੋਡ ਵੀ ਹੋ ਜਾਂਦਾ ਅਤੇ ਪਰ ਜ਼ਿਆਦਾਤਰ ਦੇਖਿਆ ਜਾਵੇ ਤਾਂ ਇਸ ਚੀਜ਼ ਦਾ ਬਹੁਤ ਫ਼ਾਇਦਾ ਵੀ ਹੈ ਅਤੇ ਦੋਨੇਂ ਚੀਜ਼ਾਂ ਹੀ ਹੁੰਦੀਆਂ ਨੇ ਅਤੇ ਪਰ ਹੌਲੀ ਹੌਲੀ ਜਿਵੇਂ ਜਿਵੇਂ ਲੋਕ ਜਾਗਰੂਕ ਹੋ ਰਹੇ ਨੇ ਪੜ੍ਹ ਰਹੇ ਨੇ ਲਿਖ ਰਹੇ ਨੇ ਅਤੇ ਇਹ ਚੀਜ਼ਾਂ ਘੱਟ ਰਹੀਆਂ ਨੇ ਹੁਣ ਫਰੋਡ ਘੱਟ ਰਹੇ ਨੇ ਅਤੇ ਥੈਂਕ ਯੂ ਸੋ ਮੱਚ